ਯਾਰ ਦੇਖ ਜੇ ਤੂੰ ਭਾਰ ਵਧਾਉਣਾ ਚਾਹੁੰਦਾ ਹੈ ਮੈਂ ਤੁਹਾਨੂੰ ਇੱਕ ਵਧੀਆ ਤਰੀਕਾ ਦੱਸਦਾ ਹਾਂ ਜੋ ਕਿ ਸਾਰਾ ਹੀ ਘਰੇਲੂ ਤਰੀਕਾ ਹੈ ਤੁਸੀਂ ਘਰ ਵਿੱਚ ਰਹਿੰਦੇ ਹੋਏ ਆਪਣਾ ਭਾਰ ਵਧਾ ਸਕਦੇ ਹੋ ਜੇ ਕੋਈ ਘੱਟ ਭਾਰ ਹੈ ਜਿਹਦਾ ਜਾਂ ਪਤਲਾ ਹੈ ਉਹ ਚਾਹੁੰਦਾ ਹੈ ਕਿ ਮੈਂ ਮੋਟਾ ਹੋਣਾ ਚਾਹੁੰਦਾ ਹਾਂ ਭਾਰ ਵਧਾਉਣਾ ਚਾਹੁੰਦਾ ਮੈਂ ਦੇਖਣ ਵਿੱਚ ਵਧੀਆ ਲੱਗਾਂ ਉਹ ਸਾਰੇ ਇਹ ਉਪਾਅ ਕਰਕੇ ਆਪਣਾ ਭਾਰ ਵਧਾ ਸਕਦੇ ਹਨ ਮੇਰੇ ਅਨੁਸਾਰ ਸ ਕਹਿ ਸਕਦਾ ਹਾਂ ਕਿ ਮੈਂ ਤੁਸੀਂ ਇਕ ਮਹੀਨੇ ਦੇ ਅੰਦਰ ਅੰਦਰ ਚਾਰ ਤੋਂ ਪੰਜ ਕਿਲੋ ਭਾਰ ਆਰਾਮ ਨਾਲ ਵਧਾ ਸਕਦੇ ਹੋ ਜਿਹਦਾ ਕੋਈ ਵੀ ਤੁਹਾਨੂੰ ਨਾ ਤੁਹਾਡੇ ਸਰੀਰ ਨੂੰ ਕੋਈ ਪ੍ਰਭਾਵ ਨਹੀਂ ਪਏਗਾ ਗਲਤ ਪ੍ਰਭਾਵ ਨਹੀਂ ਪਏਗਾ ਜੋ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਹੋਏਗਾ ਉਹਦੇ ਨਾਲ ਕੀ ਹੋਊਗਾ ਤੁਹਾਡੀ ਬੋਡੀ ਵੀ ਸਹੀ ਰਹੂਗੀ ਤੁਸੀਂ ਕੰਮ ਕਰਨ ਦੇ ਕਾਬਿਲ ਬਣੋਂਗੇ ਵਧੀਆ ਦੇਖਣ ਵਿੱਚ ਸੁੰਦਰ ਲੱਗੋਗੇ ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਸਭ ਤੋਂ ਪਹਿਲਾਂ ਤਾਂ ਤੁਸੀਂ ਸਵੇਰ ਤੋਂ ਸ਼ਾਮ ਤੱਕ ਦੀ ਇੱਕ ਰੂਟੀਨ ਬਣਾਉਣੀ ਆ ਜਿਸ ਦੇ ਅੰਦਰ ਜੋ ਸਾਰੀ ਕੰਮ ਕਰਨੇ ਮੈਂ ਤੁਹਾਨੂੰ ਦੱਸ ਰਿਹਾ ਸਭ ਤੋਂ ਪਹਿਲਾਂ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ ਹੈ ਸਵੇਰੇ ਉੱਠਦੇ ਸਾਰ ਹੀ ਇੱਕ ਤੋਂ ਦੋ ਲੀਟਰ ਪਾਣੀ ਪੀਣਾ ਪੀਣ ਤੋਂ ਬਾਅਦ ਕੁਛ ਟਾਈਮ ਬਾਅਦ ਆਪਣਾ ਫਰੈਸ਼ ਹੋ ਕੇ ਤੁਸੀਂ ਕੁਛ ਹਲਕਾ ਫੁਲਕਾ ਜਿਵੇਂ ਕਿ ਫਰੂਟ ਖਾਓ ਥੋੜ੍ਹੇ ਫਰੂਟ ਖਾਣ ਤੋਂ ਬਾਅਦ ਦਸ ਪੰਦਰ੍ਹਾਂ ਮਿੰਟ ਬਾਅਦ ਇੱਕ ਮੀਲ ਲੈਣੀ ਆ ਛੇਕ ਬਣਾਉਣਾ ਹੈ ਛੇਕ ਦੇ ਵਿੱਚ ਤੁਸੀਂ ਦੋ ਕੇਲੇ ਐਡ ਕਰਨੇ ਹਨ ਦਸ ਤੋਂ ਗਿਆਰਾਂ ਬਦਾਮ ਪਾਉਣੇ ਆ ਕਾ ਕਾਜੂ ਪਾ ਸਕਦੇ ਥੋੜ੍ਹੇ ਜਿਹੇ ਨਾਲ ਥੋੜ੍ਹੀ ਜਿਹੀ ਕਿਸ਼ਮਿਸ਼ ਪਾ ਸਕਦੇ ਹਾਂ ਸਭ ਤੋਂ ਜਰੂਰੀ ਉਹਦੇ ਵਿੱਚ ਖੰਜੂਰਾ ਪਾਉਣੀਆਂ ਤਿੰਨ ਤੋਂ ਚਾਰ ਖੰਜੂਰਾ ਪਾਣੀਆਂ ਵਿੱਚ ਇੱਕ ਚਮਚ ਸ਼ਹਿਦ ਪਾਉਣਾ ਸ਼ਾਹਿਦ ਪਾ ਕੇ ਤੁਸੀਂ ਉਹਨੂੰ ਥੋੜ੍ਹਾ ਟਾਈਮ ਬਲੈਂਡ ਕਰਨਾ ਹੈ ਉਹਦੇ ਵਿੱਚ ਥੋੜ੍ਹਾ ਜਿਹਾ ਫਿਰ ਮਿਲਕ ਪਾ ਦੇਣਾ ਜੋ ਕਿ ਆਪਣੇ ਹਿਸਾਬ ਨਾਲ ਪਾ ਲੈਣਾ ਤੁਸੀਂ ਕਿੰਨਾ ਕੁ ਪੀਣਾ ਇੱਕ ਗਲਾਸ ਬਣਾਉਣਾ ਦੋ ਗਲਾਸ ਬਣਾਉਣੇ ਆ ਉਹ ਪਾ ਕੇ ਦੋ ਕੁ ਮਿੰਟ ਉਹਨੂੰ ਬਲੈਂਡ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਉਹ ਇੱਕ ਸਿਰਪ ਟਾਈਪ ਬਣ ਜੂੰਗਾ ਸ਼ੇਕ ਬਣ ਜੂੰਗਾ ਤੁਸੀਂ ਉਹ ਪੀਣਾ ਹੈ ਪੀਣ ਤੋਂ ਕੁਛ ਸਮੇਂ ਬਾਅਦ ਤੁਸੀਂ ਹਲਕਾ ਫੁਲਕਾ ਜਿਵੇਂ ਕਿ ਕਹਿ ਸਕਦੇ ਹੋ ਸੈਲਡ ਖਾ ਸਕਦੇ ਹੋ ਸੈਲਡ ਦੇ ਵਿੱਚ ਕੀ ਹੋਉਂਗਾ ਕਿ ਖੀਰੇ ਖਾ ਲਓ ਥੋੜ੍ਹੇ ਜਿਹੇ ਨਾਲ ਹੋਰ ਖਾ ਲਓ ਉਸ ਤੋਂ ਬਾਅਦ ਜਦ ਤੁਸੀਂ ਬ੍ਰੇਕਫਾਸਟ ਕਰਨਾ ਹੈ ਉਹਦੇ ਵਿੱਚ ਬਰੈੱਡ ਲੈਣੇ ਆ ਬਰੈੱਡਾਂ ਦੇ ਵਿੱਚ ਪੀਨਟ ਬਟਰ ਲਗਾ ਕੇ ਨਾਲ ਤੁਸੀਂ ਆਂਡੇ ਖਾ ਸਕਦੇ ਤੋਂ ਆਂਡੇ ਲੈਣੇ ਹੈ ਉਹ ਖਾਣੇ ਹੈ ਬਰੈੱਡ ਬਰਾਊਨ ਬਰੈੱਡ ਹੋਣੇ ਚਾਹੀਦੇ ਹੈ ਜਿਹੜੇ ਬਰਾਊਨ ਬਰੈੱਡ ਹੁੰਦੇ ਹੈ ਦੂਸਰੇ ਬਰੈੱਡ ਨਹੀਂ ਲੈਣੇ ਉਸਦੇ ਨਾਲ ਤੁਸੀਂ ਓਟਸ ਵੀ ਲੈ ਸਕਦੇ ਹੋ ਦੁੱਧ ਦੇ ਵਿੱਚ ਉਸ ਤੋਂ ਬਾਅਦ ਆਪਣਾ ਕੁਛ ਕੰਮ ਕਰਦੇ ਹੋ ਜੋ ਕੰਮ ਕਰਨਾ ਹੈ ਫਿਰ ਦੁਪਹਿਰ ਨੂੰ ਇੱਕ ਮੀਲ ਲੈਣੀ ਆ ਉਹਦੇ ਵਿੱਚ ਤੁਸੀਂ ਹੈਵੀ ਥੋੜ੍ਹਾ ਮੀਲ ਲੈਣੀ ਆ ਜਿਵੇਂ ਕਿ ਤੁਸੀਂ ਸਾਰਾ ਦਿਨ ਕੰਮ ਕਰਨਾ ਹੈਵੀ ਮੀਲਸ ਲੈ ਸਕਦੇ ਹੋ ਜਿਹਦੇ ਵਿੱਚ ਕਿ ਤੁਸੀਂ ਜਿਵੇਂ ਕਿ ਆਪਣੇ ਕਹਿ ਸਕਦੇ ਹਰੀ ਮੂੰਗੀ ਹੁੰਦੀ ਆ ਉਹ ਭਿਉਂ ਕੇ ਲੈਣੀ ਆ ਹਰੀ ਮੂੰਗੀ ਲੈ ਲੈਣੀ ਹੈ ਕੁਛ ਦਾਲਾਂ ਲੈਣੀਆਂ ਹਰੀਆਂ ਦਾਲਾਂ ਇੱਕ ਸਬਜ਼ੀ ਅਤੇ ਚਾਵਲ ਇਹ ਜ਼ਰੂਰ ਲੈਣੇ ਹਨ ਲੈਣ ਦੇ ਨਾਲ ਇਹਦੇ ਨਾਲ ਕੀ ਹੋਊਗਾ ਤੁਸੀਂ ਸਾਰਾ ਦਿਨ ਜੋ ਕੰਮ ਕਰਦੇ ਹੋ ਉਹ ਤੁਹਾਨੂੰ ਕਰਨ ਦੀ ਊਰਜਾ ਮਿਲੂਗੀ ਉਸ ਤੋਂ ਬਾਅਦ ਜਦ ਸਾਰਾ ਦਿਨ ਵਰਕ ਆਊਟ ਕਰਨਾ ਹੈ ਆਪਣਾ ਸ਼ਾਮ ਨੂੰ ਜਿੰਮ ਜ਼ਰੂਰ ਜਾਣਾ ਹੈ ਜਾਂ ਸਵੇਰ ਦੀ ਰੂਟੀਨ ਬਣਾ ਲਓ ਜਾਂ ਸ਼ਾਮ ਦੀ ਜਿੰਮ ਨਹੀਂ ਜਾ ਸਕਦੇ ਘਰ ਵਿੱਚ ਤੁਸੀਂ ਐਕਸਰਸਾਈਜ਼ ਕਈ ਤਰ੍ਹਾਂ ਦੀਆਂ ਕਰ ਸਕਦੇ ਹੋ ਉਹਦੇ ਨਾਲ ਕੀ ਹੋਊਗਾ ਤੁਹਾਨੂੰ ਹੋਰ ਸਰੀਰ ਵਿੱਚ ਐਨਰਜੀ ਮਿਲੂੰਗੀ ਅਤੇ ਭੁੱਖ ਵਧੂਗੀ ਹੋਰ ਤੁਸੀਂ ਜ਼ਿਆਦਾ ਖਾਓਗੇ ਉਹਦੇ ਨਾਲ ਤੁਹਾਡਾ ਭਾਰ ਵਧੂਗਾ ਜਿੰਨਾ ਕੁ ਦੇਸੀ ਘਿਓ ਹੋ ਸਕਦਾ ਹੈ ਹੋਰ ਵਧੀਆ ਤੋਂ ਵਧੀਆ ਪਨੀਰ ਆਪਣਾ ਘਰ ਦਾ ਬਣਿਆ ਪਨੀਰ ਖਾਓ ਬਹੁਤ ਵਧੀਆ ਹੈ ਮੱਖਣ ਖਾਓ ਉਹਦੇ ਨਾਲ ਤੁਹਾਡੀ ਜ਼ਿਆਦਾ ਤੋਂ ਜ਼ਿਆਦਾ ਵੇਟ ਵਧਾਉਣ ਦੀ ਸ਼ਮਤਾ ਵੱਧਦੀ ਜਾਊਗੀ ਸ਼ਾਮ ਨੂੰ ਤੁਸੀਂ ਐਕਸਰਸਾਈਜ਼ ਕਰਕੇ ਆਪਣਾ ਫਰੈਸ਼ ਹੋ ਕੇ ਨਹਾ ਕੇ ਰਾਤ ਨੂੰ ਇੱਕ ਹਲਕੀ ਫੁਲਕੀ ਡਾਇਟ ਲੈਣੀ ਆ ਰਾਤ ਨੂੰ ਭਾਰਾ ਨਹੀਂ ਖਾਣਾ ਕਿ ਸਾਨੂੰ ਕਿਉਂਕਿ ਰਾਤ ਨੂੰ ਸੌਣ ਸਮੇਂ ਡਾਈਜੇਸਟ ਨਹੀਂ ਹੁੰਦਾ ਸਹੀ ਰਾਤ ਨੂੰ ਆਪਣਾ ਕੁਛ ਚਾਵਲ ਖਾ ਲੋ ਕੁਛ ਹੋਰ ਲੈ ਲਓ ਇਸ ਤਰ੍ਹਾਂ ਦਾ ਲੈ ਕੇ ਤੁਸੀਂ ਖਾਣਾ ਹੈ ਅਤੇ ਉਸ ਤੋਂ ਬਾਅਦ ਜ਼ਿਆਦਾਤਰ ਤੁਸੀਂ ਇਹ ਧਿਆਨ ਦੇਣਾ ਹੈ ਕਿ ਸਭ ਤੋਂ ਵੱਧ ਦੇਸੀ ਘਿਓ ਪਨੀਰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਜੋ ਕਿ ਘਰ ਦੀਆਂ ਬਣਾਈਆਂ ਹੋਈਆਂ ਹਨ ਸਿਆਲਾਂ ਨੂੰ ਜਿਵੇਂ ਕਿ ਖੋਏ ਦੀਆਂ ਪਿੰਨੀਆਂ ਦੇਸੀ ਘਿਓ ਦੇ ਦੀਆਂ ਪਿੰਨੀਆਂ ਅਤੇ ਖੋਆ ਇੱਦਾਂ ਦੀਆਂ ਚੀਜ਼ਾਂ ਦਾ ਸੇਵਨ ਕਰਨਾ ਗਜਰੇਲੇ ਆ ਗਜਰੇਲਾ ਬਣਾ ਲੈਂਦੇ ਹਾਂ ਆਪਾਂ ਉਸਦਾ ਸੇਵਨ ਕਰਨਾ ਇਹ ਚੀਜ਼ਾਂ ਤੁਹਾਨੂੰ ਭਾਰ ਵਧਾਉਣ ਲਈ ਸਭ ਤੋਂ ਵੱਧ ਊਰਜਾ ਦੇਣਗੀਆਂ ਅਤੇ ਭਾਰ ਵਧਾਉਣ ਵਿੱਚ ਮਦਦ ਕਰਨਗੀਆਂ